ਸਤਿ ਸ਼੍ਰੀ ਅਕਾਲ ਜੀ ਅੰਬਰ ਅਮਨ ਵਾਲੀਆ ਟਰਾਂਸਪੋਰਟ ਤੋਂ ਬੋਲਦੇ ਮੈਂ ਸਰ ਥੁ ਤੁਹਾਡੇ ਚੰਡੀਗੜ੍ਹ ਤੋਂ ਨਵੇਂ ਸ਼ਹਿਰ ਲਈ ਵੀਰਵਾਰ ਨੂੰ ਟੈਕਸੀ ਬੁੱਕ ਕਰਵਾਈ ਸੀਗੀ ਤਾਂ ਮੇਰਾ ਇਹ ਐਕਸਪੀਰੀਅੰਸ ਬਹੁਤ ਮਾੜਾ ਨਿਕਲਿਆ ਅਤੇ ਰਸਤੇ ਵਿੱਚ ਗੱਡੀ ਦੇ ਵਿੱਚ ਹੀਟਰ ਹੈ ਨਹੀਂ ਸੀਗਾ ਠੰਡ ਸੀਗੀ ਅਤੇ ਉਹ ਹੀਟਰ ਵੀ ਨਹੀਂ ਚਲਾ ਰਿਹਾ ਸੀਗਾ ਡਰਾਈਵਰ ਤਾਂ ਉਹਨੂੰ ਕਿਹਾ ਵੀ ਕਹਿੰਦਾ ਹੀਟਰ ਖਰਾਬ ਹੈ ਸੀਟ ਵੀ ਫਟੀਆ ਸੀਗੀਆਂ ਅਤੇ ਰਾ ਇੰਜਨ ਦੇ ਵਿੱਚ ਆਵਾਜ਼ ਆ ਰਹੀ ਸੀਗੀ ਰਸਤੇ ਵਿੱਚ ਗੱਡੀ ਖਰਾਬ ਹੋ ਗਈ ਖਰਾਬ ਹੋਣ ਤੋਂ ਬਾਅਦ ਉਹਨੂੰ ਹੈ ਕੁਛ ਵੀ ਨਹੀਂ ਸੀ ਹੋਣ ਵਾਲਾ ਤਾ ਕੰਮ ਹੋਣ ਵਾਲਾ ਸੀ ਗੱਡੀ ਨੇ ਉਹ ਵੀ ਨਹੀਂ ਰਾਸਤੇ 'ਚ ਖਰਾਬ ਹੋ ਗਈ ਮੈਂ ਬੜਾ ਮੁਸ਼ਕਿਲ ਦੇ ਨਾਲ ਇ ਘਰ ਪਹੁੰਚਿਆ ਉਹ ਗੱਡੀ ਦੇ ਨਾਲ ਅਤੇ ਉਸ ਡਰਾਈਵਰ ਨੇ ਇੱਕ ਵਾਰ ਵੀ ਸੋਰੀ ਨਹੀਂ ਫੀਲ ਕੀਤਾ ਉਹਨੇ ਅਤੇ ਗੱਡੀ ਦੀ ਤੁਸੀਂ ਅੱਗੇ ਤੋਂ ਫਿਊਚਰ ਵਿੱਚ ਮੈਂ ਤੁਹਾਡੀ ਗੱਡੀ 'ਚ ਆਵਾ ਤਾਂ ਤੁਸੀਂ ਉਹਦੀ ਗੱਡੀ ਗੁੱਡੀ ਰਿਪੇਅਰ ਕਰਕੇ ਸਹੀ ਕਰਾ ਕੇ ਰੱਖੋ